ਅਸੀਂ ਧਾਰਮਿਕ ਸਥਾਨ ਉੱਤੇ ਜਾਣਾ ਜ਼ਿਆਦਾ ਪਸੰਦ ਕਰਦੇ ਹਾਂ ਜਿਵੇਂ ਕਿ ਹਰਿਮੰਦਰ ਸਾਹਿਬ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਕਿਉਂਕਿ ਧਾਰਮਿਕ ਸਥਾਨਾਂ ਉੱਤੇ ਜਾ ਕੇ ਦਿਲ ਨੂੰ ਮਨ ਨੂੰ ਜੋ ਸ਼ਾਂਤੀ ਮਿਲ ਮਿਲਦੀ ਹੈ ਅਤੇ ਜੋ ਸਕੂਨ ਮਿਲਦਾ ਹੈ ਉਹ ਹੋਰ ਕਿਸੇ ਸਥਾਨ ਉੱਤੇ ਨਹੀਂ ਮਿਲਦਾ ਇਸ ਲਈ ਅਸੀਂ ਧਾਰਮਿਕ ਸਥਾਨ 'ਤੇ ਜਾਣ ਜ਼ਿਆਦਾ ਦਿਲਜਸਪੀ ਰੱਖਦੇ ਹਾਂ